ਹਾਂ ਵੀਰ ਕਿੱਥੇ ਕੁ ਪਹੁੰਚ ਗਿਆ ਅੱਛਾ ਹਜੇ ਬਠਿੰਡਾ ਨਹੀਂ ਲੰਘਿਆ ਉਹ ਭਰਾਵਾ ਜਲਦੀ ਨਿਕਲਿਆ ਸ਼ਹਿਰ 'ਚੋਂ ਨਿਕਲ ਬਾਹਰ ਥਾਣੀ ਆਜਾ ਕਦੋਂ ਦੀ ਮੈਂ ਕੈਬ ਬੁੱਕ ਕਰਵਾਈ ਹੈ ਅਜੇ ਤੂੰ ਪਹੁੰਚਿਆ ਨਹੀਂ ਉਹ ਮੇਰੀ ਟ੍ਰੇਨ ਆ ਸਾਢੇ ਚਾਰ ਵਜੇ ਮੈਂ ਟ੍ਰੇਨ ਤੋਂ ਲੇਟ ਹੋ ਜਵਾਗਾਂ ਜੇ ਤੂੰ ਨਾ ਆਇਆ ਅਤੇ ਟ੍ਰੇਨ ਮਿਸ ਹੋ ਜਾਣੀ ਆ ਜੇ ਮੇਰੇ ਕੋਲ ਸਾਧਨ ਹੁੰਦਾ ਤਾਂ ਮੈਂ ਕਿਉਂ ਤੈਨੂੰ ਬੁੱਕ ਕਰਵਾਉਂਦਾ ਤਾਂ ਮੈਂ ਕਦੋਂ ਤੋਂ ਦੋ ਘੰਟੇ ਪਹਿਲਾਂ ਮੈਂ ਕੈਬ ਬੁੱਕ ਕਰਵਾਈ ਬੈਠਾ ਤੂੰ ਅਜੇ ਨਹੀਂ ਪਹੁੰਚਿਆ ਹੁਣ ਕਿਰਪਾ ਕਰ ਕਿਸੇ ਵੀ ਰਸਤੇ ਥਾਣੀ ਆ ਹਾਂ ਸ਼ਹਿਰ ਵਿੱਚ ਦੀ ਆਏਗਾ ਬਹੁਤ ਜਾਮ ਪਊਗਾ ਤੂੰ ਸ਼ਹਿਰ ਵਿੱਚ ਥਾਣੀ ਨਾ ਆਈ ਤੂੰ ਸ਼ਹਿਰ ਦੇ ਬਾਹਰ ਬਾਹਰ ਥਾਣੀ ਆ ਜਾ ਹਾਂ ਸ਼ਹਿਰ ਦੇ ਬਾਹਰ ਬਾਹਰ ਥਾਣੀ ਆਜਾ ਅਤੇ ਜਿੰਨਾ ਵੀ ਜਲਦੀ ਹੋ ਸਕਦਾ ਜਲਦੀ ਆਜਾ ਜੇ ਟ੍ਰੇਨ ਲੰਘ ਗਈ ਨਾ ਮੈਂ ਟ੍ਰੇਨ ਦੀ ਹੁਣ ਟਿਕਟ ਵੀ ਕਨਫਰਮ ਹੋਈ ਪਈ ਹੈ ਦੂਜੀ ਗੱਲ ਰਾਈਟ ਟਾਈਮ 'ਤੇ ਟ੍ਰੇਨ ਆ ਲੇਟ ਹੁੰਦੀ ਤਾਂ ਮੈਂ ਤੈਨੂ ਕਹਿੰਦਾ ਨਾ ਟ੍ਰੇਨ ਰਾਈਟ ਟਾਈਮ 'ਤੇ ਚੱਲ ਰਹੀ ਹੈ ਉਹ ਪਹੁੰਚਣ ਵਾਲੀ ਆ ਜੇ ਟ੍ਰੇਨ ਲੰਘ ਗਈ ਤਾ ਅੱਗੇ ਯਾਰ ਮੇਰੀ ਫਲਾਈਟ ਮਿਸ ਹੋ ਜੂਗੀ ਮੈਂ ਦਿੱਲੀ ਤੋਂ ਪਟਨਾ ਸਾਹਿਬ ਨੂੰ ਜਾਣਾ ਅਤੇ ਬਠਿੰਡੇ ਤੋਂ ਟ੍ਰੇਨ ਮੇਰੀ ਰਾਈਟ ਟਾਈਮ 'ਤੇ ਹੈ ਸਾਢੇ ਚਾਰ ਵਜੇ ਦੀ ਟ੍ਰੇਨ ਆ ਇਸ 'ਤੇ ਚੜ੍ਹ ਕੇ ਪਹੁੰਚਾਂਗਾ ਤਾਂ ਹੀ ਅੱਗੇ ਪਹੁੰਚਾਂਗਾ ਹਾਂ ਹੁਣ ਵੀਰ ਮੇਰਿਆ ਜਲਦੀ ਆ ਜਾ ਜਿੰਨੀ ਜਲਦੀ ਹੋ ਸਕਦਾ ਨਾ ਸ਼ਹਿਰ ਦੇ ਬਾਹਰ ਬਾਹਰ ਥਾਣੀ ਨਾ ਬਾਈਪਾਸ ਨਿਕਲ ਕੇ ਤੂੰ ਜਲਦੀ ਤੋਂ ਜਲਦੀ ਯੂਨੀਵਰਸਿਟੀ ਪਹੁੰਚ ਜਾ ਹਾਂ ਜਲਦੀ ਵੀਰ ਮੇਰਾ ਚੰਗਾ ਵੇਟ ਕਰਦਾ ਮੈਂ